ਹਾਂਜੀ ਭਾਰਤ ਵਿੱਚ ਜਿਵੇਂ ਪੰਜਾਬ ਸਟੇਟ ਹੈ ਇਥੋਂ ਅਸੀਂ ਸਰਹੰਦ ਤੋਂ ਅਸੀਂ ਚੰਡੀਗੜ੍ਹ ਸਾਈਕਲ 'ਤੇ ਗਏ ਹਾਂ ਇਸ ਤੋਂ ਬਿਨਾਂ ਅਸੀਂ ਇਧਰੋਂ ਆਪਣੇ ਅਮਲੋਹ ਸਾਈਡ ਵੱਲ ਨੂੰ ਸਾਈਕਲ 'ਤੇ ਗਏ ਹਾਂ ਉਸ ਤੋਂ ਬਿਨਾਂ ਅਸੀਂ ਪਟਿਆਲਾ ਪਟਿਆਲੇ ਵੀ ਸਾਈਕਲ 'ਤੇ ਜਾਣਾ ਚਾਹੁੰਦੇ ਹਾਂ ਸ਼ਿਫਾਰਸ਼ਾਂ ਇਹ ਹੈ ਜੀ ਅਸੀਂ ਇਥੋਂ ਇੱਕ ਤਾਂ ਦੁਰਘਟਨਾ ਦੀ ਸਾਵਧਾਨੀ ਤੋਂ ਬਚ ਕੇ ਸਾਈਡ 'ਤੇ ਚਲਣਾ ਕਿਉਂਕਿ ਵੱਡੀਆਂ ਗੱਡੀਆਂ ਆਉਂਦੀਆਂ ਨੇ ਅਤੇ ਉਹ ਟਰੈਫਿਕ ਬਹੁਤ ਹੈ ਉਹਨਾਂ ਨੂੰ ਪਚਾਅ 'ਚ ਰੱਖਦੇ ਹੋਏ ਅਸੀਂ ਆਪਣੀ ਸੇਫਟੀ ਲਈ ਇਧਰ ਜਾਣਾ ਚਾਹੁੰਦੇ ਹਾਂ ਅਸੀਂ